ਜ਼ਿੰਦਗੀ ਵਿੱਚ ਇਨਸਾਨ ਕਈ ਇਨਸਾਨ ਅਜਿਹੇ ਹਨ ਜੋ ਸੁਬਹਾ ਜਾਂ ਸ਼ਾਮ ਲਈ ਕਸਰਤ ਵੀ ਕਰਦੇ ਹਨ ਕਸਰਤ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਇਸ ਦੇ ਨਾਲ ਨਾਲ ਕਈ ਖਿਡਾਰੀ ਆਪਣੀਆਂ ਖੇਡਾਂ ਵਿੱਚ ਯੋਗਾ ਵੀ ਕਰਦੇ ਹਨ ਕਿਉਂਕਿ ਯੋਗਾ ਜਿਹੜਾ ਸਾਡੇ ਸਰੀਰ ਨੂੰ ਮਨ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਤੰਦਰੁਸਤ ਬਣਾਉਂਦਾ ਹੈ ਯੋਗਾ ਗਾ ਜਿਹੜਾ ਸਾਡੇ ਸਰੀਰ ਨੂੰ ਨਾ ਇੱਕ ਤਰ੍ਹਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਜਿਵੇਂ ਕਸਰਤ ਕਰਨਾ ਸਾਡੇ ਸਰੀਰ ਵਿੱਚ ਮਜ਼ਬੂਤੀ ਆਉਂਦੀ ਹੈ ਅਤੇ ਸਾਡੇ ਮਸਲ ਆ ਜਿਹੜੇ ਮਜ਼ਬੂਤ ਹੁੰਦੇ ਨੇ ਹੱਡੀਆਂ ਮਜ਼ਬੂਤ ਹੁੰਦੀਆਂ ਹੈਗੀਆਂ ਇਸ ਤਰ੍ਹਾਂ ਸਾਨੂੰ ਕਸਰਤ ਕਰਨ ਦੇ ਨਾਲ ਨਾਲ ਖੇਡਾਂ ਕਰਨੇ ਨਾਲ ਨਾਲ ਯੋਗਾ ਵੀ ਕਰਨਾ ਚਾਹੀਦਾ ਹੈ ਕਿਉਂਕਿ ਯੋਗਾ ਇੱਕ ਅਲੱਗ ਪਾਰਟ ਹੈ ਅਤੇ ਸਰੀਰਕ ਕਸਰਤ ਕਰਨਾ ਅਲੱਗ ਪਾਰਟ ਹੈ ਇਹਨਾਂ ਨਾਲ ਸਰੀਰ ਮਜ਼ਬੂਤ ਹੁੰਦਾ ਹੈ ਯੋਗਾ ਨਾਲ ਮਨ ਤੰਦਰੁਸਤ ਹੁੰਦਾ ਹੈ ਅਤੇ ਕਸਰਤ ਯੋਗਾ ਦਾ ਲਚਕਦਾਰ ਅਤੇ ਇਕਾਗਰਤਾ ਸਰੀਰ ਵਿੱਚ ਪੈਦਾ ਕਰਦਾ ਹੈ ਮਨ ਸ਼ਾਂਤ ਹੁੰਦਾ ਹੈ ਕਈ ਇਨਸਾਨ ਆਮ ਤੌਰ 'ਤੇ ਸੁਬਹਾ ਕਸਰਤ ਕਰਦੇ ਹਨ ਸ਼ਾਮ ਨੂੰ ਯੋਗਾ ਵੀ ਕਰਦੇ ਹਨ ਇਸ ਕਰਕੇ ਯੋਗਾ ਅਤੇ ਕਸਰਤ ਇੱਕ ਸਿੱਕੇ ਦੇ ਦੋ ਪਹਿਲੂ ਹਨ ਜੋ ਜ਼ਿੰਦਗੀ ਦੇ ਵਿੱਚ ਸਾਨੂੰ ਕੁਛ ਨਾ ਕੁਛ ਟਾਈਮ ਕੱਢ ਕੇ ਜ਼ਰੂਰ ਕਰਨੇ ਚਾਹੀਦੇ ਹਨ ਇਸ ਤਰ੍ਹਾਂ ਇਸ ਲਈ ਇਹ ਕਸਰਤ ਕਰਨ ਦੇ ਨਾਲ ਨਾਲ ਯੋਗਾ ਨੂੰ ਵੀ ਜੋੜਨਾ ਚਾਹੀਦਾ ਹੈ ਆਮ ਤੌਰ 'ਤੇ ਕਈ ਖਿਡਾਰੀ ਅਥਲੀਟ ਜੋ ਦੇਖੇ ਗਏ ਹਨ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਏ ਹਨ ਉਹ ਆਪਣੀ ਖੇਡ ਦੇ ਨਾਲ ਨਾਲ ਯੋਗਾ ਵੀ ਕਰਦੇ ਹਨ ਅਤੇ ਕੁਛ ਟਾਈਮ ਕਸਰਤ ਕਰਦੇ ਹਨ ਅਤੇ ਕੁਛ ਟਾਈਮ ਆਪਣੀ ਖੇਡ ਨੂੰ ਵੀ ਦਿੰਦੇ ਹਨ ਅਤੇ ਜ਼ਿੰਦਗੀ ਵਿੱਚ ਕਾਮਯਾਬ ਵੀ ਹੁੰਦੇ ਹਨ ਆਪਣੇ ਟੀਚੇ ਤੱਕ ਪਹੁੰਚਦੇ ਹਨ ਇਸ ਲਈ ਕਸਰਤ ਦੇ ਨਾਲ ਨਾਲ ਯੋਗਾ ਇੱਕ ਤਰ੍ਹਾਂ ਉਸ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਈ ਹੁੰਦਾ ਹੈ